ਦਵਾਈਆਂ ਕਿਫਾਇਤੀ ਨਹੀਂ ਹਨ ਕਿਉਂਕਿ ਹਰ ਮਰੀਜ਼ ਦੇ ਜੋ ਦਵਾਈ ਹੈ ਉਹਦੀ ਬਿਮਾਰੀ ਦੇ ਹਿਸਾਬ ਨਾਲ ਲਾਈ ਜਾਂਦੀ ਹੈ ਜੇਕਰ ਕਿਸੇ ਨੂੰ ਕੋਈ ਵੱਡੀ ਬਿਮਾਰੀ ਹੈ ਵੱਡੀ ਬਿਮਾਰੀ ਹੈ ਤਾਂ ਉਹਨੂੰ ਮਹਿੰਗੀ ਦਵਾਈ ਪ੍ਰੈਫਰ ਕੀਤੀ ਜਾਂਦੀ ਹੈ ਜੇ ਕਿਸੇ ਨੂੰ ਨੋਰਮਲ ਦਵਾ ਕੋਈ ਬ ਬਿਮਾਰ ਜਿਹਾ ਹੈ ਜਿਵੇਂ ਬੁਖਾਰ ਜ਼ੁਕਾਮ ਹੈ ਤਾਂ ਉਹਨੂੰ ਉਸ ਹਿਸਾਬ ਦੀ ਦਵਾਈ ਰੈਕਮੈਂਡ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਵੀ ਮੈਂ ਆਪਣੇ ਜੋ ਹੈ ਮੈਂ ਕੋਈ ਦਵਾਈ 'ਤੇ ਖਰਚ ਨਹੀਂ ਕਰਦਾ ਕਿਉਂਕਿ ਮੈਂ ਫਿਟ ਫਾਟ ਹਾਂ ਵਧੀਆ ਮੈਂ ਗਰਾਉਂਡ ਵਗੈਰਾ ਜਾਂਦਾ ਗਾ ਉਹਦੇ ਕਰਕੇ ਮੈਨੂੰ ਕੋਈ ਵੀ ਦਵਾਈ ਲੈਣ ਦੀ ਜ਼ਰੂਰਤ ਨਹੀਂ ਪੈਂਦੀ ਹਾਲਾਂਕਿ ਜੋ ਗੌਰਮੈਂਟ ਸਕੀਮਸ ਨੇ ਜਿੱਦਾਂ ਕਿ ਆਯੁਸ਼ਮਾਨ ਕਾਰਡ ਨੇ ਉਹ ਸਾਡੇ ਬਣੇ ਹੋਏ ਨੇ ਉਹ ਜਦੋਂ ਕੋਈ ਮੰਨ ਲਓ ਵੱਡੀ ਕੋਈ ਵੀ ਬਿਮਾਰੀ ਰੱਬ ਨਾ ਕਰੇ ਕੱਲ ਨੂੰ ਕੋਈ ਵੱਡੀ ਬਿਮਾਰੀ ਪਰਿਵਾਰ ਨੂੰ ਘੇਰ ਲੈਂਦੀ ਹੈਗੀ ਹੈ ਤਾਂ ਉਹ ਉੱਥੇ ਕੰਮ ਆ ਜਾਂਦਾ ਹੈ ਇਸ ਲਈ ਮੁਫਤ ਦਵਾਈ ਕੋਈ ਵੀ ਨਹੀਂ ਮਿਲਦੀ ਉਹਦਾ ਚਾਰਜਿਸ ਵੀ ਕੱਟਿਆ ਜਾਂਦਾ ਹੈ ਪਰ ਉਹ ਜੋ ਚਾਰਜਿਸ ਪੈਂਦਾ ਹੈ ਉਸਦਾ ਉਸਦਾ ਉਹ ਸਰਕਾਰ ਪੇ ਕਰਦੀ ਹੈ ਦਵਾਈ ਬਣਾਉਣ ਦਵਾਈ ਦੇ ਪੈਸੇ ਮਿਲ ਹੀ ਜਾਣੇ ਹਨ